ਮੈਂ ਇਕ ਐਚ ਪੀ ਦਾ ਲੈਪਟੋਪ ਪਰਚੇਸ ਕੀਤਾ ਸੀ ਜਿਹੜਾ ਕਿ ਮੈਨੂੰ ਬਹੁਤ ਹੀ ਸਹੀ ਰੇਟ 'ਤੇ ਮਿਲ ਗਿਆ ਅਤੇ ਜਿਹਦੇ ਵਿੱਚ ਕਿ ਜਿਹੜੀ ਉਹਦੀ ਕੋਨਫੀਗਰੇਸ਼ਨ ਸੀਗੀ ਉਹ ਵੀ ਮੈਨੂੰ ਬਹੁਤ ਸਹੀ ਪ੍ਰਾਈਸ 'ਤੇ ਮਿਲ ਗਈਆਂ ਜਿਹਦੇ ਕਰਕੇ ਕਿ ਮੈਂ ਹੁਣ ਆਪਣਾ ਕੋਈ ਵੀ ਕੰਮ ਕਰ ਸਕਦਾ ਹਾਂ ਉਹਦੇ 'ਤੇ ਜਿਵੇਂ ਕਿ ਮਲਟੀਟਾਸਕਿੰਗ ਹੋ ਗਿਆ ਟਾਈਪਿੰਗ ਕਰ ਸਕਦਾ ਹੈ ਮੈਂ ਇੰਟਰਨੈਟ 'ਤੇ ਸਰਫ ਕਰ ਸਕਦਾ ਹਾਂ ਜਿੱਦਾਂ ਮਰਜ਼ੀ ਮਤਲਬ ਗੇਮ ਵੀ ਖੇਡ ਸਕਦਾ ਹਾਂ ਉਹਦੇ ਵਿੱਚ ਆਰ ਟੀ ਐਕਸ ਫੋਰਟੀ ਨਾਇੰਟੀ ਇੰਟਲ ਆਈ ਸੈਵਨ ਫੋਟੀਨਥ ਜਨਰੇਸ਼ਨ ਅਤੇ ਉਹਦੇ ਕੀ ਕੀ ਕੀਬੋਰਡ 'ਤੇ ਲਾਈਟਸ ਵੀ ਹੈਗੇ ਆ ਮਲਟੀ ਮਲਟੀ ਕਲਰ ਆਰ ਜੀ ਬੀ ਲਾਈਟਸ ਲੱਗੀਆਂ ਹੋਈਆਂ ਜਿਹਦੇ ਕਰਕੇ ਕਿ ਮੈਂ ਉਹਨੂੰ ਮੋਡੀਫਾਈ ਵੀ ਕਰ ਸਕਦਾ ਹਾਂ ਉਹਨੂੰ ਕਸਟਮਾਈਜ਼ ਵੀ ਕਰ ਸਕਦਾ ਆਪਣੇ ਤਰੀਕੇ ਨਾਲ ਕਿ ਉਹਤੇ ਮੈਂ ਕਿਹੜੀ ਲਾਈਟ ਲਗਾਉਣਾ ਚਾਹੁੰਦਾ ਹਾਂ ਪਲੱਸ ਉਹ ਟੱਚ ਸਕਰੀਨ ਵੀ ਹੈਗਾ ਆ ਜਿਹਦੇ ਕਰਕੇ ਕਿ ਮੈਨੂੰ ਕਦੇ ਕਦਾਰ ਕੀਬੋਰਡ ਯੂਜ ਕਰਨ ਦਾ ਜੀਅ ਨਾ ਕਰੇ ਤਾਂ ਮੈਂ ਉਹਨੂੰ ਵੀ ਯੂਜ ਕਰ ਸਕਦਾ ਹਾਂ ਅਤੇ ਫਿਰ ਉਹਦੇ ਬਾਅਦ ਉਹਤੇ ਗੇਮਸ ਆਰਾਮ ਨਾਲ ਅਸੀਂ ਖੇਡ ਸਕਦੇ ਹਾਂ ਹਰ ਇੱਕ ਕੰਮ ਆਰਾਮ ਨਾਲ ਚੱਲਦਾ ਸਮੁਥਲੀ ਚੱਲਦਾ ਆ